ਹਾਂ ਜੀ ਬਿਲਕੁਲ ਮੈਂ ਕਸਟਮਰ ਹੈ ਤੁਹਾਡਾ ਰੈਗੂਲਰ ਐਂਡ ਮੈਂ ਫਸਟ ਟਾਈਮ ਇੱਕ ਹੈਡਫੋਨ ਮੰਗਵਾਇਆ ਸੀਗਾ ਅਤੇ ਇੱਦੂ ਪਹਿਲਾਂ ਵੀ ਮੰਗਵਾਇਆ ਸੀ ਬਟ ਉਹ ਕਿਸੇ ਹੋਰ ਪਲੇਟਫਾਰਮ ਤੋਂ ਮੰਗਵਾਇਆ ਸੀਗਾ ਅਤੇ ਮੈਨੂੰ ਪ੍ਰੋਬਲਮ ਆ ਗਈ ਫਿਰ ਮੈਂ ਉਹਦੀ ਸ਼ਿਕਾਇਤ ਕੀਤੀ ਕਿ ਇਹ ਪਿਕਅੱਪ ਕਰਨਗੇ ਹੈ ਨਾ ਅਤੇ ਉਦੋਂ ਉਹਨਾਂ ਨੇ ਪਿਕਅੱਪ ਨਹੀਂ ਕੀਤਾ ਨਾ ਹੀ ਮੇਰੀ ਸਮੱਸਿਆ ਵੱਲ ਧਿਆਨ ਦਿੱਤਾ ਬਟ ਜਦੋਂ ਮੈਂ ਤੁਹਾਡੇ ਇਹ ਤੋਂ ਓਰਡਰ ਕੀਤਾ ਇੱਕ ਤਾਂ ਬਹੁਤ ਵਧੀਆ ਟਾਈਮ 'ਤੇ ਪਹੁੰਚਿਆ ਠੀਕ ਹੈ ਨਾ ਮੇਰੇ ਕੋਲ ਥਰਡ ਡੇ ਮੈਨੂੰ ਡਿਲੀਵਰੀ ਹੋ ਗਈ ਸੀ ਔਰ ਡਿਲੀਵਰੀ ਹੋਣ ਵੇਲੇ ਜੋ ਮੈਨੂੰ ਸਮੱਸਿਆ ਸੀ ਮੈਂ ਸੀਗਾ ਡਿਊਟੀ 'ਤੇ ਅਤੇ ਜੋ ਡਿਲੀਵਰੀ ਪਰਸਨ ਸੀਗੇ ਉਹਨਾਂ ਨੇ ਕਿਹਾ ਕਿ ਸਰ ਤੁਸੀਂ ਅਗਰ ਡਿਊਟੀ 'ਤੇ ਹੈਗੇ ਵੀ ਮੈਂ ਦੁਬਾਰਾ ਚੱਕਰ ਲਾ ਲਉਂਗਾ ਤੁਸੀਂ ਚਿੰਤਾ ਨਾ ਕਰੋ ਔਰ ਤੁਹਾਨੂੰ ਅਗਰ ਅਰਜੈਂਟ ਚਾਹੀਦਾ ਤਾਂ ਹੋਰ ਕੋਈ ਸਾਧਨ ਹੈ ਤਾਂ ਦੱਸੋ ਅਤੇ ਮੈਂ ਫਿਰ ਡਿਲੀਵਰੀਮੈਨ ਨੂੰ ਕਿਹਾ ਸੀ ਮੈਂ ਕਿਹਾ ਸਾਡੇ ਪੜੋਸ ਵਿੱਚ ਹੀ ਮੇਰੇ ਭਰਾ ਰਹਿੰਦਾ ਅਗਰ ਪਲੀਜ਼ ਤੁਸੀਂ ਉਹਨਾਂ ਨੂੰ ਦਿਓ ਤਾਂ ਬੜੀ ਮਿਹਰਬਾਨੀ ਹੋਊਗੀ ਪਰ ਦੇਖੋ ਮੇਰਾ ਭਰਾ ਵੀ ਘਰ ਨਹੀਂ ਸੀ ਔਰ ਡਿਲੀਵਰੀਮੈਨ ਨੇ ਅੱਧਾ ਘੰਟਾ ਘੱਟੋ ਘੱਟ ਤਾਂ ਕਿ ਮੈਨੂੰ ਮੇਰਾ ਪ੍ਰੋਡਕਟ ਮਿਲ ਪਾਵੇ ਅੱਧਾ ਘੰਟਾ ਵੇਟ ਕੀਤੀ ਇੰਨੀ ਗਰਮੀ ਵਿੱਚ ਸੋ ਆਈ ਰਿਅਲੀ ਵੈਰੀ ਗਲੈਡ ਅਤੇ ਮੈਨੂੰ ਤੁਹਾਡੀ ਸਰਵਿਸ ਤਾਂ ਚੰਗੀ ਲੱਗੀ ਲੱਗੀ ਫਿਰ ਜਦੋਂ ਮੈਂ ਪ੍ਰੋਡਕਟ ਖੋਲ੍ਹ ਕੇ ਦੇਖਿਆ ਦੈਟ ਵਾਜ਼ ਦਾ ਵੇਰੀ ਨਾਇਸ ਪ੍ਰੋਡਕਟ ਮਤਲਬ ਉਹਦਾ ਬੈਟਰੀ ਬੈਕਅਪ ਜੋ ਹੈਡਫੋਨ ਸੀ ਠੀਕ ਹੈ ਔਰ ਬਲੂਟੁੱਥ ਕਨੈਕਟੀਵਿਟੀ ਐਂਡ ਉਹਦੀ ਜੋ ਬੈਟਰੀ ਚੱਲਦੀ ਹੈ ਬੈਟਰੀ ਲਾਈਫਸਟ ਲਾਈਫ ਉਹਦੀ ਡੈਰੀ ਮਤਲਬ ਆਸਮ ਹੈ ਬਹੁਤ ਵਧੀਆ ਇਸ ਲੀਏ ਮੇਰਾ ਅਨੁਭਵ ਤਾਂ ਜੀ ਦੇਖੋ ਬਹੁਤ ਵਧੀਆ ਔਰ ਆਈ ਥਿੰਕ ਆਈ ਵਿਲ ਓਰਡਰ ਦਾ ਮੋਰ ਪ੍ਰੋਡਕਟਸ ਫਰੋੋਮ ਯੂਅਰ ਰਿਸਪੈਕਟ ਫਰੋਮ ਥੈਂਕ ਯੂ ਥੈਂਕ ਯੂ ਵੈਰੀ ਮੱਚ